ਛੱਬੀ ਜੁਲਾਈ ਉੱਨੀ ਸੌ ਚੁਰਾਨਵੇਂ ਤਿੰਨ ਦਸੰਬਰ ਉੱਨੀ ਸੌ ਉਣਹੱਤਰ ਅੱਠ ਜੂਨ ਉੱਨੀ ਸੌ ਛਿਆਨਵੇਂ ਛੇ ਜੂਨ ਉੱਨੀ ਸੌ ਚੁਰਾਸੀ ਪੰਜ ਅਗਸਤ ਉੱਨੀ ਸੌ ਛਿਆਨਵੇਂ